ਮੇਰੀ ਪਸੰਦੀਦਾ ਬਾਈਕ ਬੁਲਟ ਹੈ ਅਤੇ ਸਪਲੈਂਡਰ ਹੈ ਮੈਨੂੰ ਬੁਲਟ ਚਲਾਉਣ ਦਾ ਬਹੁਤ ਸ਼ੌਂਕ ਹੈ ਪਰ ਇਸ ਵਕਤ ਮੇਰੇ ਕੋਲ ਚਲਾਉਣ ਲਈ ਐਕਟੀਵਾ ਹੈ ਅਤੇ ਉਹ ਵੀ ਮੈਂ ਬਹੁਤ ਵਧੀਆ ਤਰ੍ਹਾਂ ਚਲਾ ਲੈਂਦੀ ਹਾਂ ਮੇਰੀ ਡਰੀਮ ਬਾਈਕ ਬੁਲੇਟ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਬੁਲਟ ਚਲਾਉਣਾ ਸਿੱਖਣਾ ਚਾਹੁੰਦੀ ਹਾਂ ਤਾਂ ਜੋ ਆਪਣਾ ਡਰੀਮ ਮੈਂ ਪੂਰਾ ਕਰ ਸਕਾਂ ਅਤੇ ਬਾਈਕਿੰਗ ਯਾਤਰਾ ਲਈ ਸਪਲੈਂਡਰ ਬਾਈਕ ਬਹੁਤ ਆਰਾਮਦਾਇਕ ਹੈ ਉਸ ਬਾਈਕ ਨੂੰ ਚਲਾਉਂਦੇ ਸਮੇਂ ਯਾਤਰੀ ਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਹੁੰਦੀ ਇਸ ਲਈ ਬਾਈਕਿੰਗ ਯਾਤਰਾ ਲਈ ਸਪਲੈਂਡਰ ਬਾਈਕ ਵਧੀਆ ਰਹਿੰਦੀ ਹੈ ਇਹ ਬਾਈਕ ਜ਼ਿਆਦਾ ਉੱਚੀ ਨਹੀਂ ਹੁੰਦੀ ਇਸ ਨੂੰ ਹਰ ਤਰ੍ਹਾਂ ਦਾ ਬੰਦਾ ਚਲਾ ਲੈਂਦਾ ਹੈ ਉੱਚਾ ਲੰਮਾ ਗਿੱਠਾ ਇਸ ਲਈ ਇਸ ਬਾਈਕ ਦਾ ਬਾਈਕ ਨਾਲ ਕਿਸੇ ਵੀ ਕਿਸੇ ਨੂੰ ਵੀ ਦਿੱਕਤ ਨਹੀਂ ਹੁੰਦੀ ਸਪਲੈਂਡਰ ਬਾਈਕ ਬਾਈਕਿੰਗ ਯਾਤਰਾ ਲਈ ਵਧੀਆ ਰਹਿੰਦੀ ਹੈ